ਹੈਲੋ ਮੇਰੀ ਗੱਲ ਦਾਵਤ ਵਾਲਿਆਂ ਨਾਲ ਹੋ ਰਹੀ ਆ ਹਾਂਜੀ ਥੋੜ੍ਹਾ ਖਾਣੇ ਦਾ ਔਡਰ ਬੁੱਕ ਕਰਿਓ ਭਾਅ ਜੀ ਹਾਂਜੀ ਥੋੜ੍ਹਾ ਜਿਹਾ ਨਾ ਮਿਰਚ ਮਸਾਲਾ ਥੋੜ੍ਹਾ ਘੱਟ ਰੱਖਿਓ ਸਾਡੇ ਘਰ ਬਜ਼ੁਰਗ ਵੀ ਆਏ ਨੇ ਅਤੇ ਸ ਪ੍ਰਾਹੁਣੇ ਹੋਰ ਵੀ ਆਏ ਨੇ ਜਿਹੜੇ ਬਜ਼ੁਰਗ ਨੇ ਉਹ ਮਸਾਲਾ ਘੱਟ ਖਾਂਦੇ ਨੇ ਤਾਂ ਤੁਸੀਂ ਥੋੜ੍ਹਾ ਲੂਣ ਮਿਰਚ ਦੂ ਦੂਜਿਆਂ ਵਿੱਚ ਵੀ ਤੇਜ ਪਾ ਦਿਓ ਦਾਲ ਮੱਖਣੀ ਕਰ ਦਿਓ ਨਾਨ ਕਰ ਦਿਓ ਬਟਰ ਨਾਨ ਕਰ ਦਿਓ ਅਤੇ ਪਨੀਰ ਕਰ ਦਿਓ ਅਤੇ ਬਾਕੀ ਜੋ ਵੀ ਆ ਸਾਰਾ ਸਮਾਨ ਪੈਕ ਕਰਕੇ ਸਾਡੇ ਘਰ ਭੇਜ ਦੇਣਾ ਅਤੇ ਕੁਝ ਵਿੱਚ ਮਠਿਆਈ ਵੀ ਪਾਣੀ ਜੀ ਇਹ ਗਜਰੇਲਾ ਪਾ ਦਿਓ ਬਰਫੀ ਪਾ ਦਿਓ ਅਤੇ ਰਸ ਮਲਾਈ ਪਾ ਦਿਓ ਉਹਦੇ ਵਿੱਚ ਵੀ ਥੋੜ੍ਹੀ ਜਿਹੀ ਚੀਨੀ ਤੁਸੀਂ ਘੱਟ ਹੀ ਰੱਖਿਓ ਕਿਉਂਕਿ ਸਾਡੇ ਬਜ਼ੁਰਗ ਚੀਨੀ ਘੱਟ ਖਾਂਦੇ ਆ ਸਾਡੇ ਪਾਪਾ ਜੀ ਨੂੰ ਸ਼ੂਗਰ ਹੈਗੀ ਹੈ ਇਸ ਵਾਸਤੇ ਤੁਸੀਂ ਵਧੀਆ ਖਾਣਾ ਭੇਜੋਗੇ ਜਾਂ ਮਠਿਆਈ ਵਧੀਆ ਭੇਜੋਗੇ ਫਿਰ ਤੁਹਾਨੂੰ ਆਡਰ ਦੁਬਾਰਾ ਦੇਵਾਂਗੀ ਅਤੇ ਮੇਰਾ ਅਡਰੈਸ ਨੋਟ ਕਰ ਲਓ ਅਡਰੈਸ ਨੋਟ ਕਰ ਲਓ ਇਹ ਰਜਵੰਤ ਕੌਰ ਪ੍ਰਤਾਪ ਬਾਜ਼ਾਰ ਅਤੇ ਸਾਹਮਣੇ ਮੇ ਪ੍ਰਤਾਪ ਬਜ਼ਾਰ ਦੇ ਸਾਹਮਣੇ ਕਾਲੀ ਜਿਹੀ ਗੱਡੀ ਕਾਲੀ ਗੱਡੀ ਸਾਹਮਣੇ ਦਰਖਤ ਆ ਔਰ ਸਾਹਮਣੇ ਮੇਰੀ ਕੋਠੀ ਹੈ ਜੇਕਰ ਤੁਹਾਨੂੰ ਕੋਈ ਦਿੱਕਤ ਹੋਏ ਤਾਂ ਤੁਸੀਂ ਦੁਬਾਰਾ ਫੋਨ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ